ਆਵਾਜਾਈ ਦਿਨ ਬ ਦਿਨ ਸਾਇੰਸ ਨਵੀਂ ਤਕਨੀਕਾਂ ਨਾਲ ਆਸਾਨ ਕਰ ਰਹੀ ਹੈ ਕਿ ਇਨਸਾਨ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਾਸਤੇ ਇਹ ਕਸ਼ਟ ਨਾ ਹੋਵੇ ਅਤੇ ਉਹ ਆਰਾਮ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚ ਸਕੇ ਅਤੇ ਆਵਾਜਾਈ ਨਾਲ ਸਾਡਾ ਚੱਲਣਾ ਦਾ ਕੰਮ ਘੱਟ ਗਿਆ ਹੈ ਜਿਸ ਨਾਲ ਸਾਨੂੰ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਵਾਜਾਈ ਦੀ ਇਸ ਵਰਤੋ ਦੇ ਨਾਲ਼ ਅਸੀਂ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਾਂ ਜਿਸ ਨਾਲ ਕਈ ਲੋਕਾਂ ਦੀ ਮੌਤ ਵੀ ਹੋ ਰਹੀ ਹੈ ਅਤੇ ਹੁਣ ਅੱਜ ਦੇ ਸਮੇਂ ਵਿੱਚ ਦੇਖ ਸਕਦੇ ਹਾਂ ਅਸੀਂ ਕਿ ਇਲੈਕਟ੍ਰੀਕਲ ਸਕੂਟਰ ਜਾਂ ਇਲੈਕਟ੍ਰੀਕਲ ਗੱਡੀਆਂ ਦੀ ਵਰਤੋਂ ਆ ਹੋ ਰਹੀ ਹੈ ਜਿਸ ਨਾਲ਼ ਜਿਸ ਨਾਲ ਇਨਸਾਨ ਦਾ ਖਰਚਾ ਘੱਟ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਅਸੀਂ ਵਾਤਾਵਰਨ ਨੂੰ ਵੀ ਘੱਟ ਕਸ਼ਟ ਪਹੁੰਚਾ ਰਹੇ ਹਨ ਅਤੇ ਇਲੈਕਟ੍ਰੀਕਲ ਸਕੂਟਰ ਅੱਜ ਤੋਂ ਕੁਛ ਸਮੇਂ ਪਹਿਲੇ ਇਹ ਇੱਥੇ ਨਹੀਂ ਸੀਗੇ ਹੁਣ ਉਹ ਸੰਸਾਰ ਵਿੱਚ ਸਾਇੰਟਿਸਟ ਦੁਆਰਾ ਇਸ ਦਾ ਵਿਕਾਸ ਕੀਤਾ ਜਾ ਰਿਹਾ ਹੈ